ਸ ਸਤਿ ਸ਼੍ਰੀ ਅਕਾਲ ਰਾਜਵੀਰ ਮੈਮ ਤੁਸੀਂ ਦੱਸੋ ਕਿਵੇਂ ਹੋ ਵਧੀਆ ਮੈਂ ਵੀ ਹਾਂਜੀ ਹਾਂਜੀ ਕੁਛ ਨਹੀਂ ਬਸ ਫਰੀ ਬੈਠੇ ਸੀਗੇ ਹਾਂਜੀ ਹਾਂਜੀ ਹਾਂਜੀ ਸੀਗੇ ਹਾਂਜੀ ਉਹ ਬਸ ਮੈਂ ਤਾਂ ਇਹੀ ਸੋਚਿਆ ਕਿ ਜਿਹੜੀ ਮੇਰੀ ਕਲਾਸ ਵਿੱਚ ਹੈ ਨਾ ਲੋਕਲ ਸਟੂਡੈਂਟਸ ਹੈਗੇ ਆ ਮੈਂ ਉਹਨਾਂ ਦੀ ਹੈਲਪ ਲੈ ਲੂੰਗੀ ਉਹਨਾਂ ਨੂੰ ਕਹਿ ਦੂੰਗੀ ਕਿ ਹੈ ਨਾ ਤੁਸੀਂ ਜ਼ਿਆਦਾਤ ਜ਼ਿਆਦਾ ਟਾਈਮ ਤੱਕ ਸਟੇ ਕਰ ਲੈਣਗੇ ਵਧੀਆ ਡੈਕੋਰੇਸ਼ਨ ਵਗੈਰਾ ਆਪਣੀ ਵਧੀਆ ਹੋ ਜਾਊਗੀ ਬੈਲੂਨਸ ਵਗੈਰਾ ਮੁੰਡਿਆਂ ਤੋਂ ਆਪਾਂ ਮੰਗਵਾ ਲਵਾਂਗੇ ਅਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਮ ਹਮ ਹਮ ਹਮ ਹਾਂ ਅੱਗੇ ਆਪਾਂ ਨੂੰ ਸੀਨੀਅਰ ਦੇ ਵਿੱਚ ਹੈਗੀਆਂ ਆ ਕੁੜੀਆਂ ਮੈਨੂੰ ਜਾਣਦੀਆਂ ਹੈਗੀਆਂ ਅਤੇ ਬਸ ਉਹਨਾਂ ਨੂੰ ਆਪਾਂ ਕਹਿ ਦੇਵਾਂਗੇ ਕਿ ਥੋੜ੍ਹੀ ਜਿਹੀ ਹੈਲਪ ਕਰ ਦੇਣਗੇ ਆਪਣੇ ਜਿਵੇਂ ਪ੍ਰਾਈਮਰੀ ਸਕੂਲ 'ਚ ਆਪਾਂ ਸੋਰੀ ਪ੍ਰਾਈਮਰੀ ਸੈਕਸ਼ਨ 'ਚ ਆਪਾਂ ਬੱਚਿਆਂ ਨੂੰ ਹੈ ਨਾ ਪ੍ਰਪੇਅਰ ਕਰਾਵਾਂਗੇ ਤਾਂ ਬਸ ਵੱਡੀਆਂ ਕੁੜੀਆਂ ਦੀਆਂ ਹੈਲਪ ਲੈ ਲਵਾਂਗੇ ਉਹ ਦੱਸ ਦੇਣਗੇ ਬਾਕੀ ਰੀਫਰੈਸ਼ਮੈਂਟ ਦਾ ਦੱਸੋ ਤੁਸੀਂ ਕੀ ਕਹੋਗੇ ਹਮ ਹਮ ਹਮ ਹਮ ਹਮ ਹਮ ਹਮ ਹਾਂਜੀ ਹਾਂਜੀ ਹਾਂਜੀ ਅਤੇ ਫਲੈਗ ਵੀ ਮੈਂ ਹਾਂਜੀ ਫਲੈਗ ਦੀ ਉਹ ਜਿਹੜੀ ਰੱਸੀ ਜਿਹੀ ਆ ਉਹ ਵੀ ਕਹਿੰਦੇ ਸੀਗੇ ਕਿ ਪ੍ਰਿੰਸਪਲ ਸਰ ਕਹਿੰਦੇ ਸੀਗੇ ਕਿ ਉਹ ਵੀ ਨਵੀਂ ਲੈ ਕੇ ਆਇਓ ਪੁਰਾਣੀ ਹੋ ਗਈ ਧੁੱਪੇ ਪੈ ਪੈ ਕੇ ਅਤੇ ਨਾਲ ਉਹਦੇ ਵਿੱਚ ਫਲੈਗ ਵਿੱਚ ਰੈਪ ਕਰਨ ਵਾਸਤੇ ਆਪਾਂ ਨੂੰ ਰੋਜ਼ਿਜ਼ ਦੇ ਪੈਟਲ ਵੀ ਚਾਹੀਦੇ ਨੇ ਹੈ ਨਾ ਹਾਂਜੀ ਉਹ ਤਾਂ ਫ੍ਰੈਸ਼ ਹੀ ਪਏ ਆ ਹਾਂਜੀ ਹਾਂਜੀ ਹਾਂਜੀ ਹਮ ਹਮ

ਹਾਂ ਹਾਂਜੀ ਫੰਡਸ ਤਾਂ ਆਪਣੇ ਕੋਲ ਬਹੁਤ ਆ ਪ੍ਰਿੰਸੀਪਲ ਸਰ ਨੇ ਕਿਹਾ ਕਿ ਜੇ ਫੰਡ ਘੱਟ ਵੀ ਪੈਂਦਾ ਹੋਇਆ ਤਾਂ ਤੁਸੀਂ ਕਹਿੰਦੇ ਕਿ ਮੈਨੂੰ ਆ ਕੇ ਤੁਸੀਂ ਰਿਕੁਐਸਟ ਕਰ ਸਕਦੇ ਹੋ ਕਿ ਮੇਰੇ ਫੰਡ ਨੂੰ ਤੱਕ ਲੈ ਕੇ ਕੋਈ ਪ੍ਰੋਬਲਮ ਨਹੀਂ ਬਾਕੀ ਡੈਕੋਰੇਸ਼ਨ ਦਾ ਵੀ ਹੋ ਜੂਗਾ ਆਪਣਾ ਹੈ ਨਾ ਰੀਫਰੈਸ਼ਮੈਂਟ ਦਾ ਵੀ ਹੋ ਜੂਗਾ ਬਾਕੀ ਮੈਂ ਬੱਚਿਆਂ ਤੋਂ ਪੁੱਛ ਲੂੰਗੀ ਕਿ ਕਿਹੜੇ ਕਿਹੜੇ ਬੱਚੇ ਇੰਟਰਸਟ ਨੇ ਡਾਂਸ ਕਰਨ ਵਿੱਚ ਉਹਦਾ ਵੀ ਆਪਾਂ ਕਰ ਲਵਾਂਗੇ ਜਿਹੜੀ ਕਰਵਾਉਣੀ ਆ ਡਰੈਸਸ ਵਗੈਰਾ ਕਿਵੇਂ ਆ ਮਤਲਬ ਕਰਨਾ ਹਮ ਹਮ ਹਮ ਹਾਂਜੀ ਹਾਂਜੀ ਤਾਂ ਫਿਰ ਦੱਸ ਦਿਉ ਮੈਨੂੰ ਕੱਲ੍ਹ ਮੇਰਾ ਸੈਕਿੰਡ ਪੀਰੀਡ ਫਰੀ ਹੈ ਕਾਲ ਬਸ ਠੀਕ ਆ ਹਾਂਜੀ ਹਾਂਜੀ ਫਿਰ ਆਪਾਂ ਕੱਲ੍ਹ ਸੈਕਿੰਡ ਪੀਰੀਅਡ 'ਚ ਮਿਲਦੇ ਹਾਂ ਠੀਕ ਹਾਂਜੀ